ਮੈਂ ਹਾਲੇ ਤੱਕ ਆਪਣੀ ਲਾਈਫ 'ਚ ਕੋਈ ਸਾਜ ਵਜਾਣਾ ਨਹੀਂ ਸਿੱਖਿਆ ਹਾਂਜੀ ਪਰ ਅਗਰ ਮੈਂ ਅੱਗੇ ਕੋਈ ਸਿਖਣਾ ਚਾਹਵਾਂਗੀ ਤਾਂ ਮੈਂ ਗਿਟਾਰ ਵਜਾਣਾ ਜਰੂਰ ਸਿਖਣਾ ਚਾਹਾਂਗੀ ਕਿਉਂਕਿ ਜਦੋਂ ਵੀ ਆਪਾਂ ਗਾਨੇ ਆ ਸਾਨੂੰ ਮਤਲਬ ਅਗਰ ਪਿੱਛੇ ਕੋਈ ਮਿਊਜਿਕ ਚੱਲ ਰਿਹਾ ਹੋਵੇ ਉਹਦੇ ਨਾਲ ਸਾਡੀ ਗਾਇਕੀ ਜਿਹੜੀ ਹੋਰ ਨਿਖਰ ਕੇ ਆਉਂਦੀ ਹੈ ਇਹ ਹੈ ਕਿ ਗਿਟਾਰ ਹੋਰ ਜਿਹੜੇ ਇੰਸਟਰੂਮੈਂਟਸ ਹੁੰਦੇ ਆ ਉਹਨਾਂ ਨੂੰ ਬੜਾ ਕੋੰਸਿੰਟ੍ਰੇਟ ਕਰਨਾ ਪੈਂਦਾ ਜਿਹਦੇ ਨਾਲ ਤੁਸੀਂ ਅੱਛੀ ਤਰੀਕੇ ਨਾਲ ਗਾ ਨਹੀਂ ਪਾਉਂਦੇ ਪਰ ਗਿਟਾਰ ਦੇ ਨਾਲ ਇਹ ਕਿ ਤੁਸੀਂ ਗਿਟਾਰ ਵੀ ਵਜਾ ਸਕਦੇ ਹੋ ਨਾਲ ਨਾਲ ਤੇ ਆਪਣਾ ਆਰਾਮ ਨਾਲ ਗਾ ਵੀ ਸਕਦੇ ਹੋ ਤੁਹਾਨੂੰ ਬੈਕਗਰਾਊਂਡ ਮਿਊਜਿਕ ਵੀ ਮਿਲਦਾ ਰਹੇਗਾ ਅਗਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਗਿਟਾਰ ਜਰੂਰ ਵਜਾਣਾ ਸਿੱਖਣਾ ਚਾਵਾਂਗੀ